ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਮੈਨੂੰ ਅਲੱਗ ਅਲੱਗ ਡਿਸ਼ਿਜ ਬਣਾਉਣੀਆ ਬਹੁਤ ਪਸੰਦ ਨੇ ਅਤੇ ਮੇਰੇ ਘਰ ਦੇ ਮੇਰੇ ਹੱਥ ਦਾ ਬਣਿਆ ਹੋਇਆ ਖਾਣਾ ਖਾ ਕੇ ਬਹੁਤ ਖੁਸ਼ ਹੁੰਦੇ ਨੇ ਜਦੋਂ ਮੈਂ ਛੋਟੀ ਹੁੰਦੀ ਸੀ ਮੈਨੂੰ ਛੋਟੇ ਹੁੰਦਿਆਂ ਤੋਂ ਹੀ ਖਾਣਾ ਬਣਾਉਣ ਦਾ ਬਹੁਤ ਸ਼ੌਕ ਹੈ ਪਰ ਮੈਂ ਇਹਨੂੰ ਐਜ਼ ਆ ਪ੍ਰੋਫੈਸ਼ਨ ਨਹੀਂ ਲੈ ਕੇ ਜਾ ਸਕੀ ਕਿਉਂਕਿ ਮੈਂ ਇੰਜੀਨੀਅਰ ਬਣ ਗਈ ਪਰ ਕਦੇ ਕਦੇ ਮੈਨੂੰ ਇੱਦਾਂ ਲੱਗਦਾ ਆ ਕਿ ਅਗਰ ਮੈਂ ਇੰਜਨੀਅਰ ਨਾ ਹੁੰਦੀ ਤਾਂ ਮੈਂ ਬਹੁਤ ਵਧੀਆ ਸ਼ੈੱਫ ਹੁੰਦੀ ਅਤੇ ਬਹੁਤ ਆਪਣਾ ਹੀ ਇੱਕ ਅਲੱਗ ਹੋਟਲ ਖੋਲ੍ਹ ਕੇ ਮੈਂ ਉਹਦੇ ਵਿੱਚ ਮੈਂ ਇਸ ਚੀਜ਼ ਨੂੰ ਪ੍ਰਮੋਟ ਕਰਦੀ ਖਾਣੇ ਨੂੰ ਪ੍ਰਮੋਟ ਕਰਦੀ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਆ ਖਾਣਾ ਬਣਾਉਣਾ ਅਤੇ ਉਹਨੂੰ ਸਰਵ ਕਰਨਾ ਆਪਣੀ ਰਿਲੇਟਿਵਸ ਦੇ ਵਿੱਚ ਆਪਣੇ ਫਰੈਂਡਸ ਦੇ ਵਿੱਚ ਆਪਣੇ ਕੁਲੀਗਸ ਦੇ ਵਿੱਚ